ਸਾਡੇ ਘਰ ਦੇ ਕੋਲ ਇੱਕ ਪਾਰਕ ਹੈ ਜਿੱਥੇ ਸਵੇਰੇ ਸ਼ਾਮ ਪੰਛੀ ਚਹਿ ਚਹਾਉਂਦੇ ਹਨ ਬਹੁਤ ਬਹੁਤ ਸਾਰੇ ਇਕੱਠੇ ਹੋ ਕੇ ਕਬੂ ਇਕੱਠੇ ਰਹਿੰਦੇ ਹਨ ਫਿਰ ਵੀ ਇੱਕ ਮਿਸਾਲ ਹੁੰਦੀ ਹੈ ਸਾਰੇ ਪੰਛੀ ਏ ਏਕਤਾ ਦੇ ਨਾਲ ਰਹਿੰਦੇ ਹਨ ਪਰ ਉਹ ਜਦੋਂ ਮੈਂ ਦੇਖਦੀ ਹਾਂ ਪ ਪਾਰਕ ਵਿੱਚ ਸਵੇਰੇ ਸਵੇਰੇ ਸਾਰੇ ਪੰਛੀ ਇਕੱਠੇ ਹੋ ਕੇ ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾ ਅਵਾ ਆਵਾਜ਼ਾਂ ਕੱਢਦੇ ਹਨ ਤਾਂ ਇਹੀ ਪਤਾ ਚੱਲਦਾ ਹੈ ਕਿ ਕਿਆ ਇਹ ਜਿਹੜੇ ਹੈ ਨੇ ਆਪਸ ਵਿੱਚ ਕਿੰਨੇ ਮਿਲ ਜੁਲ ਕੇ ਰਹਿੰਦੇ ਹਨ ਅਤੇ ਸਾਨੂੰ ਵੀ ਇਹ ਸ਼ਿਕਸ਼ਾ ਦਿੰਦੇ ਹਨ ਕਿ ਅਸੀਂ ਸਾਰੇ ਆਦਮੀ ਇਕੱਠੇ ਹੋ ਕੇ ਰਹੀਏ ਪਾਰਕ ਵਿੱਚ ਜਦੋਂ ਜਾਓ ਤਾਂ ਮਨ ਨੂੰ ਇੰਨਾ ਸਕੂਨ ਮਿਲਦਾ ਹੈ ਕਿ ਪੰਛੀਆਂ ਵਾਂਗ ਅਸੀਂ ਵੀ ਚਹਿ ਚਹਾਈਏ ਅਤੇ ਖੁੱਲ੍ਹੇ ਮਾਹੌਲ ਵਿੱਚ ਰਹੀਏ

ਖਰਾਬ ਕਰ ਰਿਹਾ ਹੈ ਪੰਛੀਆਂ ਨੂੰ ਦੇਖ ਕੇ ਤੇ ਸਾਡਾ ਵੀ ਅੱਖਾਂ ਖੁੱਲ੍ਹੇ ਆਕਾਸ਼ ਵਿੱਚ ਉੱਡਣ ਨੂੰ ਦਿਲ ਕਰਦਾ ਹੈ ਇਹ ਆਪਸ ਵਿੱਚ ਆਪਣੀਆਂ ਗੱਲਾਂ ਕਰਦੇ ਹਨ ਭਾਸ਼ਾ ਸਮਝ ਨਹੀਂ ਆਉਂਦੀ ਪਰ ਉਹਨਾਂ ਨੂੰ ਆਪਣੇ ਵਿੱਚ ਸਮਝ ਆਉਂਦੀ ਹੈ ਅਤੇ ਆਪਸ ਵਿੱਚ ਪਿਆਰ ਭਾਵ ਨਾਲ ਰਹਿੰਦੇ ਹਨ ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਅਸੀਂ ਸਾਰੇ ਮਨੁੱਖ ਵੀ ਇੱਕ ਦੂਸਰੇ ਨਾਲ ਪਿਆਰ ਭਾਵ ਨਾਲ ਰਹਿਣ ਅਤੇ ਸਾਨੂੰ ਪੰਜਾਬ ਪੰਛੀਆਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਇਹ ਸਾਡੇ ਲਈ ਨੂੰ ਇਹੀ ਖਾਸ ਬਣਾਉਂਦੇ ਹਨ ਕਿ ਅਸੀਂ ਇਹਨਾਂ ਦੀ ਤਰ੍ਹਾਂ ਇੱਕ ਦੂਜੇ ਨਾਲ ਭਾਈਚਾਰਾ ਬਣਾ ਕੇ ਰੱਖੀਏ ਧੰਨਵਾਦ